ਮੈਂ ਰਮਨਦੀਪ ਸਿੰਘ ਤੁਹਾਡੇ ਸਾਰੇ ਯਾਰਾਂ ਦੇ ਨਾਲ ਜਿਹੜੀ ਹੈ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਜਿਹੜੀ ਇਹ ਪੰਜਾਬ ਦੇ ਵਿੱਚ ਜਿਹੜੀ ਘੁੰਮਣ ਵਾਲੀ ਜਗ੍ਹਾ ਵਾ ਉਨ੍ਹਾਂ ਵਿੱਚੋਂ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜਿਹੜਾ ਵਾ ਉਹ ਸਭ ਤੋਂ ਵਧੀਆ ਜਿਹੜੀ ਆ ਉਹ ਘੁੰਮਣ ਵਾਲੀ ਜਗ੍ਹਾ ਵਾ ਜਿਹੜੇ ਲੋਕ ਬਾਹਰੋਂ ਆਉਂਦੇ ਹੈ ਮੈਂ ਤਾਂ ਉਹਨਾਂ ਲੋਕਾਂ ਨੂੰ ਇਹੀ ਅਡਵਾਇਸ ਕਰਾਂਗਾ ਸਲਾਹ ਦੇਵਾਂਗਾ ਪੀ ਉਹ ਇੱਥੇ ਆਉਣ ਅਤੇ ਆ ਕੇ ਉਹ ਦੇਖਣ ਇੱਥੋਂ ਦੀ ਖੂਬਸੁਰਤੀ ਅਤੇ ਸਾਡੇ ਜਿਹੜੇ ਸਿੱਖਾਂ ਸਿੱਖ ਧਰਮ ਦੀ ਜਿਹੜੀ ਆ ਉਹਦੇ ਵਿੱਚ ਉਨ੍ਹਾਂ ਨੇ ਉਨ੍ਹਾਂ ਦੀ ਜਿਹੜੀ ਆ ਝਲਕ ਜਿਹੜੀ ਆ ਉਹ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਹੈ ਉਹ ਦੇਖਣ ਨੂੰ ਮਿਲੇਗੀ ਉਨ੍ਹਾਂ ਨੂੰ ਸਾਰੇ ਦਾ ਸਾਰੇ ਜਿਹੜਾ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਿਹੜਾ ਵਾ ਪਹਿਲੇ ਨੰਬਰ 'ਤੇ ਅਤੇ ਉਹ ਸਾਰਾ ਗੋਲਡਨ ਰੰਗ ਦਾ ਸੁਨਹਿਰੀ ਰੰਗ ਦਾ ਜਿਹੜਾ ਵਾ ਪੂਰੇ ਦਾ ਪੂਰੇ ਸੁਨਹਿਰੀ ਰੰਗ ਦਾ ਹੋਏ ਹੋਏ 'ਤੇ ਇੱਕ ਪਰਤ ਚੜ੍ਹੀ ਦੀ ਹੈ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਚੜ੍ਹਵਾਈ ਆ ਆਪਣੇ ਟੈਮ ਦੇ ਉੱਤੇ ਉਸ ਦੀ ਜਿਹੜੀ ਆ ਆਪਣੀ ਹੀ ਇੱਕ ਚਮਕ ਵਾ ਉਸ ਦਾ ਇੱਕ ਆਪਣਾ ਹੀ ਰੁਤਬਾ ਵਾ ਉਹ ਦੇਖ ਕੇ ਮਨ ਖੁਸ਼ ਹੋ ਜਾਂਦਾ ਵਾ ਉਹਦੇ ਵਿੱਚ ਬਾਕੀ ਓਥੇ ਇੰਨੇ ਲੋਕ ਲੋਕ ਆਉਂਦੇ ਹੈ ਇੰਨੇ ਸ਼ਰਧਾਲੂ ਆਉਂਦੇ ਆ ਲੋਕ ਆਉਂਦੇ ਆ ਆਪਣੀਆਂ ਮੰਨਤਵਾਂ ਮੰਗਦੇ ਹੈ ਇੱਛਾਵਾਂ ਮੰਗਦੇ ਆ ਅਤੇ ਸਾਰਿਆਂ ਨੇ ਜਿਹੜੀਆਂ ਇੱਛਾਵਾਂ ਜਿਹੜੀਆਂ ਵਾ ਉਹ ਓਥੇ ਮਹਾਰਾਜ ਪੂਰੀਆਂ ਕਰਦੇ ਹੈ ਉਨ੍ਹਾਂ ਦੀਆਂ ਅਤੇ ਮੈਂ ਓਥੇ ਘੁੰਮਣ ਫਿਰਨ ਦੇ ਲਈ ਅਤੇ ਇੱਕ ਰਿਲੀਜੀਅਸ ਪਲੇਸ ਦੇ ਪਰਪਸ ਦੇ ਲਈ ਵੀ ਓਥੇ ਬਹੁਤ ਹੀ ਇਕ ਵਧੀਆ ਜਗ੍ਹਾ ਵਾ ਨਾਲੇ ਅੰਮ੍ਰਿਤਸਰ ਜਿਹੜਾ ਵਾ ਵੈਸੇ ਵੀ ਬਹੁਤ ਹੀ ਵਧੀਆ ਸ਼ਹਿਰ ਵਾ ਗੁਰੂ ਦੀ ਨਗਰੀ ਆ ਗੁਰੂ ਰਾਮਦਾਸ ਜੀ ਦਾ ਸ਼ਹਿਰ ਵਾ ਓਥੇ ਜਿਹੜਾ ਵੀ ਕੋਈ ਬਾਹਰੋਂ ਆਏਗਾ ਅਤੇ ਮੈਂ ਤਾਂ ਉਨ੍ਹਾਂ ਨੂੰ ਇਹੀ ਕਹਿਣਾ ਚਾਹਾਂਗਾ ਪੀ ਉਹ ਓਥੇ ਘੁੰਮ ਕੇ ਆਉਣ ਇੱਕ ਵਾਰੀ ਵੇਖਣ ਓਥੋਂ ਦੀ ਖੂਬਸੁਰਤੀ ਵੇਖਣ ਓਥੇ ਜਾ ਕੇ ਮਨ ਨੂੰ ਜਿਹੜਾ ਸ਼ਾਂਤੀ ਮਿਲਦੀ ਹੈ ਉਹ ਬਹੁਤ ਹੀ ਵਧੀਆ ਵਾ ਬਾਕੀ ਗੁਰੂ ਮਹਾਰਾਜ ਨੇ ਇੱਕ ਰੀਤ ਚਲਾਈ ਦੀ ਆ ਓਥੇ ਜਿਹਦੇ ਵਿੱਚ ਲੰਗਰ ਅਤੇ ਪੰਗਤ ਦੀ ਜਿਹੜੀ ਆ ਓਥੇ ਚੌਵੀ ਘੰਟੇ ਹਰ ਵੇਲੇ ਉੱਥੇ ਲੰਗਰ ਚੱਲਦਾ ਵਾ ਚੌਵੀ ਘੰਟੇ ਕਿਤੇ ਕੋਈ ਹੀ ਥਾਂ ਹੋਵੇਗਾ ਜਿੱਥੇ ਚੌਵੀ ਘੰਟੇ ਲੰਗਰ ਮਿਲਦਾ ਵਾ ਉਹ ਦਰਬਾਰ ਸਾਹਿਬ ਵਿੱਚ ਤੁਹਾਨੂੰ ਜਿਹੜਾ ਵਾ ਉਹ ਜ਼ਰੂਰ ਦੇਖਣ ਨੂੰ ਮਿਲੇਗਾ ਚੌਵੀ ਘੰਟੇ ਲੰਗਰ ਅਤੇ ਲੰਗਰ ਵੀ ਜਿਹੜਾ ਵਾ ਉਹ ਬਹੁਤ ਹੀ ਵਧੀਆ ਗਰਮਾ ਗਰਮ ਜਿਹੜਾ ਵਾ ਉਹ ਖਾਣ ਨੂੰ ਮਿਲਦਾ ਵਾ ਮਤਲਬ ਕਿ ਕੋਈ ਵੀ ਛਕੇਗਾ ਅਤੇ ਮਨ ਪ੍ਰਸੰਨ ਹੋ ਜਾਏਗਾ ਉਹਦਾ